ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਗੱਲ ਕਰ ਰਿਹਾ ਸੀਗਾ ਭਾਅ ਜੀ ਮੈਂ ਤੁਹਾਨੂੰ ਇੱਕ ਕੰਪਲੇਂਟ ਲਿਖਾਉਣੀ ਸੀਗੀ ਕਿ ਮੈਂ ਤੁਹਾਡੇ ਰੈਸਟੋਰੈਂਟ ਤੋਂ ਖਾਣਾ ਔਡਰ ਕੀਤਾ ਸੀਗਾ ਸਵਿਗੀ ਥਰੂ ਜੋ ਕੀ ਮੇਰੇ ਤੱਕ ਹਜੇ ਤੱਕ ਪੁਜਿਆ ਨਹੀਂ ਪਰ ਐਪ 'ਤੇ ਦੱਸ ਰਿਹਾ ਹੈਗਾ ਕਿ ਮੇਰਾ ਔਡਰ ਮੈਨੂੰ ਡਿਲੀਵਰ ਹੋ ਗਿਆ ਪੈਸੇ ਮੇਰੇ ਤੁਹਾਡੇ ਤੱਕ ਪੁੱਜ ਗਏ ਆ ਪੈਸੇ ਮੇਰੇ ਕਟ ਹੋ ਗਏ ਹੈ ਘਰ ਸਾਡੇ ਗੈਸਟ ਆਏ ਜ਼ੇ ਸੀਗੇ ਉਹ ਵਿਚਾਰੇ ਭੁੱਖੇ ਆ ਨਿਰਾਸ਼ ਆ ਤੁਹਾਨੂੰ ਪਤਾ ਸਾਡੇ ਘਰ ਫੁੱਫੜ ਅਤੇ ਭੂਆ ਆਏ ਦੇ ਉਹ ਤਾਂ ਵੈਸੇ ਹੀ ਬੜੇ ਤੇਜ਼ ਹੁੰਦੇ ਤੁਹਾਨੂੰ ਪਤਾ ਹੀ ਆ ਮੈਂ ਕਿੰਨੀ ਦਿਲ 'ਤੇ ਪੱਥਰ ਰੱਖ ਕੇ ਤੁਹਾਡੇ ਕੋਲ ਪਹਿਲਾਂ ਰੋਟੀ ਮੰਗਾਈ ਉਹ ਵੀ ਟਾਈਮ 'ਤੇ ਡਿਲੀਵਰ ਨਾ ਹੋਈ ਬਹੁਤ ਮਾੜੀ ਗੱਲ ਆ ਤੁਹਾਡੇ ਤਾਂ ਰੈਸਟੋਰੈਂਟ ਦਾ ਨਾਮ ਹੀ ਬੜਾ ਵਧੀਆ ਸੀਗਾ ਪਰ ਮੈਨੂੰ ਲੱਗਦਾ ਕਿ ਹੁਣ ਜਿਹਨੇ ਜਿਹਨੇ ਮੈਨੂੰ ਕਿਹਾ ਕਿ ਤੁਹਾਡੇ ਰੈਸਟੋਰੈਂਟ ਬੈਸਟ ਹੈ ਔਡਰ ਕਰਨ ਲਈ ਹੁਣ ਨਾ ਸਾਰਿਆਂ ਨੂੰ ਕਹਿਣਾ ਪੈਣਾ ਕਿ ਨਹੀਂ ਇਹ ਤਾਂ ਕੰਮ ਖਰਾਬ ਹੀ ਆ ਸੋ ਮੇਰੀ ਤੁਹਾਨੂੰ ਇੱਕ ਇਹ ਹੀ ਬੇਨਤੀ ਆ ਕਿ ਜਲਦ ਤੋਂ ਜਲਦ ਮੇਰਾ ਮਸਲਾ ਹੱਲ ਕੀਤਾ ਜਾਵੇ ਅਤੇ ਮੈਨੂੰ ਮੇਰਾ ਔਡਰ ਪੁਜਾਇਆ ਜਾਵੇ ਧੰਨਵਾਦ